ਜਿਵੇਂ ਕੀ ਪਿੰਡਾਂ ਵਿੱਚ ਨਗਰ ਪੰਚਾਇਤ ਬਣੇ ਹੁੰਦੇ ਆ ਸ਼ਹਿਰਾਂ ਵਿੱਚ ਨਗਰ ਪਾਲਿਕਾਵਾਂ ਬਣਿਆ ਹੁੰਦਾ ਉਹਨਾਂ ਦਾ ਕੰਮ ਹੈ ਕਿ ਜਿਵੇਂ ਸੜਕਾਂ ਵਗੈਰਾ ਦਾ ਸਟ੍ਰੀਟ ਵਗੈਰਾ ਦੀਆਂ ਲਾਈਟਾਂ ਦਾ ਨਾਲੀਆਂ ਵਗੈਰਾ ਦਾ ਸੀਵਰ ਵਗੈਰਾ ਦਾ ਹੋਰ ਜਿਵੇਂ ਕੋਈ ਨਾ ਕੰਮ ਵੇਖਣਾ ਹੋਵੇ ਉਹ ਸਾਰਾ ਇਹ ਕੰਮ ਵੇਖਦੇ ਆ ਅਤੇ ਸਿਵਰ ਵਗੈ ਸਿਵਰ ਵਗੈਰਾ ਦਾ ਜ ਕੰਮ ਵੇਖਦੇ ਆ ਸੜਕਾਂ ਕਿਵੇਂ ਬਣਾਉਣੀਆਂ ਕਿਵੇਂ ਨਹੀਂ ਬਣਾਉਣੀਆਂ ਸੜਕ ਕਿੰਨੀ ਚੌੜੀ ਰੱਖਣੀ ਹੈ ਕਿੰਨਾ ਨਹੀਂ ਸਾਰਾ ਵੇਖਦੇ ਆ ਅਤੇ ਆਹਾ ਹੋਰ ਪੰਚਾਇਤੀ ਕੰਮ ਵੀ ਹੁੰਦੇ ਜਿਵੇਂ ਪਿੰਡਾਂ 'ਚ ਉਹ ਵੀ ਸਾਰਾ ਵੇਖਦੇ ਆ ਆਹਾ ਸ਼ਮਸ਼ਾਨ ਘਾਟ ਦੀ ਭੂਮਿਕਾ ਵੀ ਉਹੀ ਵੇਖਦੇ ਆ ਵੀ ਕਿ ਚਾਰ ਦੀਵਾਰੀ ਕਰਨੀ ਹੈ ਜਾਂ ਕਿਵੇਂ ਬਣਾਉਣਾ ਕਿਸ ਤਰ੍ਹਾਂ ਬਣਾਉਣਾ ਹੈ ਸ਼ਮਸ਼ਾਨ ਘਾਟ ਉਹਦਾ ਵੀ ਜਿਵੇਂ ਹੋਰ ਵੀ ਹੋ ਗਈਆਂ ਸੜਕ ਮਹਿਕਮੇ ਵਿੱਚ ਹੋਰ ਵੀ ਚੀਜ਼ਾਂ ਬਥੇਰੀਆਂ ਨੇ ਉਹ ਵੀ ਸਾਰਾ ਕੰਮ ਇਹਨਾਂ ਦਾ ਹੁੰਦਾ ਏ ਨਗਰਪਾਲਿਕਾ ਬਥੇਰਾ ਕੁਛ ਕਰਦੀ ਹੈ ਬਥੇਰਾ ਕੰਮ ਇਹਨਾਂ ਦਾ ਲੋਕਾਂ ਵਿੱਚ ਵੀ ਇਹ ਬਹੁਤ ਕੰਮ ਕਰਦੀ ਹੈ ਲੋਕਾਂ ਨੂੰ ਦੇਖਦੀ ਆ ਕੋਈ ਸੁਵਿਧਾ ਦੀ ਲੋੜ ਹੈ ਕਿਸ ਸੁਵਿਧਾ ਦੀ ਲੋੜ ਕਿਸ ਸੁਵਿਧਾ ਦੀ ਨਹੀਂ ਲੋੜ ਉਹ ਵੀ ਇਹ ਸਾਰਾ ਕੰਮ ਦੇਖਦੀ ਆ ਸਾਰਾ ਕੰਮ ਇਹਨਾਂ ਦੁਆਰਾ ਕੀਤਾ ਜਾਂਦਾ ਹੈ ਪਿੰਡਾਂ ਵਿੱਚ ਤਾਂ ਸੜਕਾਂ ਵਗੈਰਾ ਛੱਪੜ ਵਗੈਰਾ 'ਤੇ ਵੀ ਜਿਵੇਂ ਦੇ ਚਾਰ ਦੀਵਾਰੀ ਕਰਨੀ ਹੈ ਛੱਪੜਾਂ 'ਤੇ ਕਿੰਨਾਂ ਕ ਕਿੰਨਾਂ ਕਰਨਾ ਏ ਕਿੰਨੀ ਕੁ ਚਾਰ ਦੀਵਾਰੀ ਨਹੀਂ ਕਰਨੀ ਹੈ ਇਹ ਸਾਰਾ ਕੰਮ ਇਹਨਾਂ ਦੁਆਰਾ ਕੀਤਾ ਜਾਂਦਾ ਹੈ